ਸੈਲਾਨੀਆਂ ਨਾਲ ਗੱਲਬਾਤ ਕਰਨੀ ਬਹੁਤ ਵਧੀਆ ਲੱਗਦੀ ਹੈ ਅਤੇ ਸਾਰਿਆਂ ਨਾਲੋਂ ਪਹਿਲਾਂ ਮੈਂ ਮਿਲੇ ਸੀਗੇ ਹਰਿਮੰਦਰ ਸਾਹਿਬ ਉੱਥੇ ਸੈਲਾਨੀ ਮਿਲੇ ਸੀ ਮੈਂ ਛੋਟਾ ਜਿਹਾ ਸੀਗਾ ਅਤੇ ਮੇਰੇ ਨਾਲ ਫੋਟੋ ਕੀਤੀ ਉਦੋਂ ਐਨਾ ਨਹੀਂ ਉਹ ਸੀ ਫੇਰ ਇੱਕ ਦੋ ਜਗ੍ਹਾ ਹੋਰ ਮਿਲੇ ਘੁੱਦੇ ਮਿਲੇ ਅਤੇ ਉੱਥੇ ਵੀ ਮੈਂ ਗੱਲਾਂ ਕੀਤੀਆਂ ਉਹਨਾਂ ਨੂੰ ਪੁੱਛਿਆ ਵਿਚਾਰ ਪੁੱਛੇ ਉਹਨਾਂ ਦੇ ਵੀ ਕਿਵੇਂ ਤੁਹਾਡੇ ਮੌਸਮ ਹੁੰਦਾ ਕੀ ਕੀ ਕਲਚਰ ਆ ਤੁਹਾਡੇ ਉਹਨਾਂ ਨੇ ਵੀ ਮੈਨੂੰ ਪੁੱਛਿਆ ਅਤੇ ਕਾਫੀ ਗਿਆਨ 'ਚ ਵਾਧਾ ਹੋਇਆ ਉਹਦੇ ਨਾਲ ਕਾਫੀ ਫਰਕ ਪਿਆ ਹੋਰ ਵੀ ਵੈਸੇ ਵਧੀਆ ਲੱਗਦਾ ਸੈਲਾਨੀਆਂ ਨਾਲ ਕਿਉਂਕਿ ਆਂਏਂ ਹੁੰਦਾ ਕਿ ਆਪਾਂ ਆਪਦਾ ਕਲਚਰ ਤਾਂ ਜਾਣਦੇ ਹੀ ਹਾਂ ਆਪਦੀਆਂ ਚੀਜ਼ਾਂ ਤਾਂ ਜਾਣਦੇ ਹੀ ਹਾਂ ਜੇ ਆਪਾਂ ਦੂਜੇ ਦੀ ਪੁੱਛ ਕੇ ਕਾਫੀ ਖੁਸ਼ੀ ਮਹਿਸੂਸ ਹੁੰਦੀ ਹੈ ਹਾਂ ਵੀ ਤੁਹਾਡੇ ਕਿੱਥੇ ਹੁੰਦਾ ਫੇਰ ਆਪਾਂ ਵਾਅਦਾ ਵੀ ਕਰਦੇ ਹਾਂ ਉਹਨਾਂ ਨਾਲ ਮੈਂ ਇੱਕ ਦੋ ਜਣਿਆਂ ਨਾਲ ਵਾਅਦਾ ਵੀ ਕੀਤਾ ਵੀ ਇਹ ਮੈਨੂੰ ਮੌਕਾ ਮਿਲਿਆ ਤਾਂ ਮੈਂ ਆਊਂਗਾ ਜ਼ਰੂਰ ਤੁਹਾਡੇ ਉੱਥੇ ਵਿਜਿਟ ਕਰੂੰਗਾ ਅਤੇ ਉਹ ਕਹਿੰਦੇ ਤੁਸੀਂ ਆਇਓ ਕੋਈ ਦਿੱਕਤ ਨਹੀਂ ਬਹੁਤ ਹੀ ਵਧੀਆ ਲੱਗਦਾ ਚੰਗੇ ਵਿਚਾਰ ਆਉਂਦੇ ਆ ਜਾਂਦੇ ਆ ਬਹੁਤ ਹੀ ਵਧੀਆ ਲੱਗਦਾ ਸੈਲਾਨੀਆਂ ਨਾਲ ਮਿਲ ਕੇ